ਹੈਲੋ ਹੈਲੋ ਹਾਂਜੀ ਨਮਸਤੇ ਜੀ ਹਾਂਜੀ ਮੈਂ ਨਾ ਮਤਲਬ ਆਪਣੇ ਗੁਰਦਾਸਪੁਰ ਤੇ ਮੈਂ ਨਾ ਨਮ ਨਿਊ ਆਈ ਹਾਂ ਹਾਂਜੀ ਹਾਂਜੀ ਅਤੇ ਬਾਕੀ ਮੈਨੂੰ ਇਸ ਬਾਰੇ ਕੁਛ ਦੱਸੋ ਕਿ ਮਤਲਬ ਕਿ ਇੱਥੋਂ ਦਾ ਖਾਣਾ ਕਿਹੋ ਜਿਹਾ ਮਤਲਬ ਕਿ ਕਿਸ ਚੀਜ਼ ਦਾ ਮਤਲਬ ਕਿ ਵਧੀਆ ਪਸੰਦ ਕਰਦੇ ਹੈ ਕਿਉਂਕਿ ਸਾਡੇ ਤਾਂ ਉੱਧਰ ਸਾਊਥ 'ਚ ਅਲੱਗ ਤਰ੍ਹਾਂ ਦਾ ਖਾਣਾ ਹੈ ਔਰ ਮੈਂ ਜਾਣਕਾਰੀ ਲੈਣਾ ਚਾਹੁੰਦੀ ਹਾਂ ਵੀ ਇੱਥੋਂ ਦਾ ਮਤਲਬ ਕਿ ਜਿਸ ਤਰ੍ਹਾਂ ਮਤਲਬ ਸਾਡੇ ਸਰੀਰ ਨੂੰ ਵੀ ਵਧੀਆ ਲੱਗੇ ਕਿ ਕਿਸ ਤਰ੍ਹਾਂ ਦਾ ਖਾਣਾ ਸਾਨੂੰ ਖਾਣਾ ਠੀਕ ਹੈ ਜੀ ਹੋਰ ਇਹ ਤੋਂ ਇਲਾਵਾ ਜੀ ਹਾਂਜੀ ਹਾਂਜੀ

ਅੱਛਾ ਜੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਅੱਛਾ ਜੀ ਮਤਲਬ ਕਿ ਸਾਨੂੰ ਇਹ ਬਜ਼ਾਰ 'ਚ ਮਿਲ ਸਕਦਾ ਆਰਾਮੀ ਨਾਲ ਹੈ ਨਾ ਆਸਾਨੀ ਨਾਲ ਮਿਲ ਸਕਦਾ ਹੈ ਨਾ

ਠੀਕ ਹੈ ਜੀ ਹਾਂਜੀ

ਠੀਕ ਹੈ ਹਾਂਜੀ ਠੀਕ ਹੈ ਜੀ ਅੱਛਾ ਜੀ ਠੀਕ ਹੈ ਠੀਕ ਹੈ ਜੀ ਠੀਕ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਥੈਂਕਿਊ ਤੁਹਾਡਾ ਜੀ ਤੁਸੀਂ ਮੈਨੂੰ ਮਤਲਬ ਦੱਸਿਆ ਠੀਕ ਹੈ ਜੀ ਓਕੇ ਬਾਏ